ਸਰਫਿੰਗ ਬੋਰਡ ਅਕਸਰ ਜਿਹੜਾ ਹੈ ਸਮੁੰਦਰ ਵਿੱਚ ਵਰਤਿਆ ਜਾਂਦਾ ਇਸ ਦੀ ਬਣਤਰ ਅਤੇ ਬੋਰਡ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਜ਼ਿਆਦਾਤਰ ਸਰਫਿੰਗ ਬੋਰਡ ਲੱਕੜ ਦਾ ਹੁੰਦਾ ਹੈ ਵਧੀਆ ਸਰਫਿੰਗ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ ਵਿੱਚ ਹੁੰਦੀ ਹੈ